ਉਂਝ ਤਾਂ ਮੈਨੂੰ ਬਹੁਤ ਤਰ੍ਹਾਂ ਦੇ ਗੀਤ ਸੁਣਨਾ ਅਤੇ ਗਾਉਣਾ ਪਸੰਦ ਹੈ ਪਰੰਤੂ ਸਭ ਤੋਂ ਵੱਧ ਮੈਨੂੰ ਜਗਜੀਤ ਸਿੰਘ ਦੀਆਂ ਗਜ਼ਲਾਂ ਸੁਣਨਾ ਪਸੰਦ ਹੈ ਜਿਵੇਂ ਕਿ ਯੇਹ ਕਾਗਜ਼ ਕੀ ਕਸ਼ਤੀ ਇਸ ਤੋਂ ਇਲਾਵਾ ਪੰਜਾਬੀ ਗਾਇਕਾਂ ਦੇ ਵਿੱਚ ਨਿਮਰਤ ਖਹਿਰਾ ਜਿਸ ਦੇ ਗਾਣੇ ਦਾਦੀਆਂ ਨਾਨੀਆਂ ਦੇ ਸਮਿਆਂ 'ਚੋਂ ਅਤੇ ਸੁਹਾਗਣ ਵਰਗੇ ਗਾਣੇ ਮੈਨੂੰ ਬਹੁਤ ਪਸੰਦ ਹਨ ਇਸ ਤੋਂ ਇਲਾਵਾ ਤਰਸੇਮ ਜੱਸੜ ਦਾ ਗੀਤ ਜ਼ਿੰਦਗੀ ਅਤੇ ਸ਼ੈਰੀ ਮਾਨ ਦਾ ਵੀ ਇੱਕ ਹੋਰ ਗੀਤ ਜ਼ਿੰਦਗੀ ਬਹੁਤ ਪਸੰਦ ਹੈ